ਹੈਲੋ ਹਾਂ ਸਤਿ ਸ਼੍ਰੀ ਅਕਾਲ ਸਰ ਸਰ ਤੁਸੀਂ ਇੱਥੋਂ ਦੇ ਫਤਿਹਗੜ੍ਹ ਸਾਹਿਬ ਅਤੇ ਗਾਈਡੈਂਸ ਬੋਲ ਰਹੇ ਓਂ ਹਾਂ ਹਾਂਜੀ ਸਰ ਸਰ ਮੈਂ ਉਰੇ ਵਿਜਿਟ ਕਰਨਾ ਸੀ ਹਾਂਜੀ ਸਰ ਤੁਸੀਂ ਦੱਸ ਸਕਦੇ ਉਰੇ ਘੁੰਮਣ ਨੂੰ ਕੀ ਕੀ ਪਲੇਸ ਨੇ ਠੀਕ ਹੈ ਸਰ ਸਰ ਮੈਂ ਇਹ ਪੁੱਛਣਾ ਸੀਗਾ ਵੀ ਉਰੇ ਮਤਲਬ ਕੀ ਕੀ ਸਰ ਮੈਂ ਸਾਰੀਆਂ ਪਲੇਸ 'ਤੇ ਘੁੰਮਣਾ ਚਾਹੁੰਦੀ ਹਾਂ ਸਰ ਥੋੜ੍ਹਾ ਜਿਹਾ ਦੱਸੋਗੇ ਡਿਟੇਲ 'ਚ ਹਾਂਜੀ ਸਰ ਠੀਕ ਹੈ ਸਰ ਠੀਕ ਹੈ ਸਰ ਹੋਰ ਕੀ ਹੈ ਸਰ ਉਰੇ ਘੁੰਮਣ ਨੂੰ ਹਾਂਜੀ ਸਰ ਇਹਦੇ ਵਿੱਚ ਕੀ ਹੈ ਦੇਖਣ ਨੂੰ ਘੁੰਮਣ ਨੂੰ ਹਾਂਜੀ ਸਰ ਹਾਂਜੀ ਸਰ ਗੁਰਦੁਆਰਾ ਸਾਹਿਬ ਬਾਰੇ ਕੁਛ ਦੱਸੂਗੇ ਹਾਂਜੀ ਸਰ ਗੁਰਦੁਆਰਾ ਸਾਹਿਬ 'ਚ ਕਿਵੇਂ ਦੱਸ ਸਕਦੇ ਹੋ ਕਿ ਇਤਿਹਾਸ ਹੈ ਠੀਕ ਹੈ ਸਰ ਹੋਰ ਕੁਝ ਸਰ ਦੱਸ ਸਕਦੇ ਹੋ ਠੀਕ ਹੈ ਸਰ ਹਾਂ ਠੀਕ ਹੈ ਸਰ ਹਾਂਜੀ ਸਰ ਉਹਦੇ ਵਿੱਚ ਕੀ ਹੈ ਦੱਸੋਂਗੇ ਥੋੜ੍ਹਾ ਜਾ ਡਿਟੇਲ 'ਚ ਠੀਕ ਹੈ ਸਰ ਸਰ ਸਰ ਤੁਸੀਂ ਕਿੰਨੇ ਪੈਸੇ ਲਉਂਗੇ ਮੈਨੂੰ ਗਾਈਡ ਕਰਨ ਦੇ ਠੀਕ ਹੈ ਸਰ ਸਰ ਕੋਈ ਨਾ ਮੈਂ ਇੱਕ ਅੱਧੇ ਦਿਨ 'ਚ ਵਿਜਿਟ ਕਰਨਾ ਸਰ ਮੈਂ ਤੁਹਾਨੂੰ ਕਾ ਮੈਨੂੰ ਅੱਗੇ ਗਾਈਡ ਕਰਿਓ ਹਾਂਜੀ ਸਰ ਥੈਂਕ ਯੂ ਸਰ